ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਜਮਾਟੋ ਵਿੱਚ ਪੀਜ਼ਾ ਔਡਰ ਕੀਤਾ ਗਿਆ ਸੀ ਪਰ ਅਜੇ ਤੱਕ ਮੇਰੇ ਕੋਲੇ ਪਹੁੰਚਿਆ ਨਹੀਂ ਹੈ ਤੁਹਾਡੇ ਵੱਲੋਂ ਵੀਹ ਮਿੰਟ ਕਿਹਾ ਗਿਆ ਸੀ ਕਿੰਨਾ ਕੁ ਟਾਈਮ ਹੋਰ ਲੱਗ ਜਾਵੇਗਾ ਮੇਰੇ ਕੋਲੇ ਪਹੁੰਚਣ ਨੂੰ ਪਲੀਜ਼ ਦੱਸਣ ਦੀ ਖੇਚਲ ਕਰੋਗੇ